ਸਾਡੇ ਧਰਮ ਵਿੱਚ ਵਿਸ਼ੇਸ਼ ਤਰ੍ਹਾਂ ਦੇ ਪਕਵਾਨ ਪਕਾਏ ਜਾਂਦੇ ਹਨ ਜਿਵੇਂ ਕਿ ਮਿਠਾਈਆਂ ਹੋ ਗਈਆਂ ਅਤੇ ਵਿਸ਼ੇਸ਼ ਤਰ੍ਹਾਂ ਦੇ ਖਾਣ ਭੋਜਨ